ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲਦੇ ਪਏ ਹੋ ਹਾਂਜੀ ਮੈਮ ਕਿੱਥੋਂ ਬੋਲਦੇ ਪਏ ਹੋ ਹਾਂਜੀ ਹਾਂਜੀ ਦੱਸੋ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਸਾਡਾ ਸੈਂਟਰ ਕਪੂਰਥਲਾ ਚ ਹੈ ਸ਼ਹਿਰ ਦੇ ਵਿੱਚ ਹੀ ਅਤੇ ਸਾਡੀਆਂ ਕਲਾਸਿਜ ਸ਼ਾਮ ਦੀਆਂ ਵੀ ਹੁੰਦੀਆਂ ਨੇ ਅਤੇ ਸਵੇਰ ਦੀਆਂ ਵੀ ਹੁੰਦੀਆਂ ਨੇ ਤੁਸੀਂ ਕਿਹੜਾ ਟਾਈਮ ਆਉਣਾ ਚਾਹੁੰਦੇ ਹੋ ਅੱਛਾ ਤੁਸੀਂ ਵਰਕਿੰਗ ਹੋ ਕੀ ਜੋਬ ਕਰਦੇ ਹੋ ਠੀਕ ਹੈ ਠੀਕ ਹੈ ਅਤੇ ਕੀ ਟਾਈਮਿੰਗ ਹੈ ਤੁਹਾਡੇ ਸਕੂਲ ਦੀ ਜਿੱਦਾਂ ਕਦੋਂ ਫ੍ਰੀ ਹੁੰਦੇ ਹੋ ਹਾਂਜੀ ਹਾਂਜੀ ਸ਼ਾਮ ਦੇ ਤੁਹਾਡਾ ਠੀਕ ਰਹੇਗਾ ਅਤੇ ਤੁਸੀਂ ਇਕੱਲਿਆਂ ਨੇ ਕਰਨਾ ਕਿ ਨਾਲ ਤੁਹਾਡੇ ਕੋਈ ਆਉਣਾ ਨਾਲ ਚਾਹੁੰਦਾ ਠੀਕ ਹੈ ਠੀਕ ਹੈ ਮੈਮ ਮੈਂ ਤੁਹਾਨੂੰ ਕੋਰਸ ਦੇ ਬਾਰੇ ਦੱਸ ਦਿੰਦੀ ਹਾਂ ਕਿ ਵਨ ਆਰ ਦਾ ਵੀ ਇਹ ਟੂ ਆਰ ਦਾ ਵੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਵੰਨ ਆਰ ਕਰਨਾ ਚਾਹੁੰਦੇ ਹੋ ਜਾਂ ਦੋ ਘੰਟਿਆਂ ਦਾ ਠੀਕ ਹੈ ਠੀਕ ਹੈ ਉਹ ਕਿਉਂਕਿ ਪੇਮੈਂਟ ਤਾਂ ਉੱਨੀ ਲੱਗਣੀ ਆ ਜੋ ਖਰਚਾ ਹੋਏਗਾ ਉਹਦੇ ਵਿੱਚ ਹੀ ਸਾਰਾ ਕਵਰ ਹੋ ਜਾਏਗਾ ਠੀਕ ਹੈ ਅਤੇ ਇੱਕ ਘੰਟੇ ਦੀ ਜੇ ਤੁਸੀਂ ਕਲਾਸ ਲੈਂਦੇ ਹੋ ਅਤੇ ਕੋਈ ਪ੍ਰੋਬਲਮ ਨਹੀਂ ਇੱਦਾਂ ਕੀ ਹੈ ਇਹਦੇ ਵਿੱਚ ਕੀ ਹੁੰਦਾ ਇੱਕ ਅਤੇ ਤੁਹਾਨੂੰ ਜਿੱਦਾਂ ਘਰ ਅੱਜ ਕੱਲ੍ਹ ਦੇਖਿਆ ਅਸੀਂ ਘਰਾਂ 'ਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਹੈ ਨਾ ਕੋਈ ਨਾ ਕੋਈ ਸਟਰੈਸ ਹੁੰਦਾ ਘਰ ਦੀ ਕੋਈ ਕਿਸੇ ਨੂੰ ਬਿਜ਼ਨਸ ਦੀ ਟੈਂਸ਼ਨ ਹੈ ਕਿਸੇ ਨੂੰ ਪੜ੍ਹਾਈ ਦੀ ਟੈਂਸ਼ਨ ਹੈ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ 'ਚ ਵੀ ਬਹੁਤ ਸਟਰੈਸ ਆ ਰਿਹਾ ਅਤੇ ਇਹ ਸਾਡੇ ਯੋਗਾ ਮੈਡੀਟੇਸ਼ਨ 'ਚ ਇਹ ਹੁੰਦਾ ਤੁਹਾਡਾ ਮਾਇੰਡ ਇਕਦਮ ਪੀਸਫੁਲ ਰਹਿੰਦਾ ਹੈ ਨਾ ਸਟਰੈਸ ਤੁਹਾਡੇ ਤੋਂ ਦੂਰ ਜਾਏਗੀ ਅਤੇ ਬਹੁਤ ਅੱਜ ਕੱਲ੍ਹ ਬਹੁਤ ਬੱਚਿਆਂ 'ਚ ਵੀ ਪਾਇਆ ਜਾ ਰਿਹਾ ਬੱਚਿਆਂ ਨੂੰ ਵੀ ਭਾਵੇਂ ਪੰਜ ਜਾਂ ਦਸ ਮਿੰਟ ਘਰ ਤੁਸੀਂ ਕਰਵਾਓ ਅਤੇ ਬਹੁਤ ਬੈਨੀਫਿਟ ਰਹਿੰਦਾ ਇਹਦਾ ਹੋਰ ਤੁਹਾਨੂੰ ਕੁਝ ਡਾਊਟ ਹੈ ਜਾਂ ਕੁਝ ਤੁਸੀਂ ਪੁੱਛਣਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਅਤੇ ਕੋਈ ਗੱਲ ਨਹੀਂ ਬਾਕੀ ਤੁਸੀਂ ਚਾਰਜਿਜ ਦਾ ਵਨ ਮੰਥ ਅਗਰ ਤੁਸੀਂ ਕਰਦੇ ਹੋ ਅਤੇ ਥਾਊਸੈਂਡ ਚਾਰਜਿਸ ਲੱਗਣਗੇ ਠੀਕ ਹੈ ਅਤੇ ਜੇ ਤੁਸੀਂ ਪੂਰਾ ਪੈਕਜ ਲੈਂਦੇ ਹੋ ਛੇ ਮਹੀਨਿਆਂ ਦਾ ਅਤੇ ਉਦੋਂ ਤੁਹਾਨੂੰ ਆਪਾਂ ਥਾਊਡੈਂਡ ਲੈਸ ਕਰਕੇ ਫਾਈਵ ਥਾਊਜੈਂਡ ਵਿੱਚ ਪੂਰਾ ਪੈਕੇਜ ਦੇ ਦਿਆਂਗੇ ਛੇ ਮਹੀਨਿਆਂ ਦਾ ਨਹੀਂ ਫੀਸ ਅਤੇ ਐਡਵਾਂਸ ਹੀ ਲੱਗੇਗੀ ਨਾ ਜਿਦਾਂ ਤੁਸੀਂ ਜੁਆਇਨ ਕੀਤਾ ਅੱਜ ਅਤੇ ਤੁਸੀਂ ਐਡਵਾਂਸ 'ਚ ਦਿਓਗੇ ਚਲੋ ਠੀਕ ਹੈ ਮੈਮ ਤੁਸੀਂ ਇਕ ਵਾਰ ਵਿਜਿਟ ਕਰਿਓ ਹਾਂਜੀ ਹਾਂਜੀ ਓਕੇ ਜੀ ਓਕੇ